ਅੱਜ ਕੱਲ੍ਹ ਦੁਨੀਆਂ ਬਹੁਤ ਸੌਖੀ ਹੋ ਗਈ ਹੈ ਪਹਿਲਾਂ ਪਹਿਲਾਂ ਬਾਲਣ ਇਕੱਠਾ ਕਰੋ ਸਿਆਲ ਵਾਸਤੇ ਰੋਟੀ ਬਣਾਉਣ ਵਾਸਤੇ ਨਹਾਉਣ ਧੋਣ ਵਾਸਤੇ ਪਾਣੀ ਗਰਮ ਕਰਨਾ ਫਿਰ ਉਹਦੇ 'ਤੇ ਚੁੱਲ੍ਹੇ 'ਤੇ ਕਰਕੇ ਬਾਲਣ ਦੀ ਵਰਤੋਂ ਕਰੀਦੀ ਸੀਗੀ ਅਤੇ ਫਿਰ ਸਿਆਲ ਦੇ ਵਿੱਚ ਬਾਲਣ ਇਕੱਠਾ ਕਰਕੇ ਰੱਖਣਾ ਬ ਸਰਦੀਆਂ ਵਿੱਚ ਸੌਖੇ ਰਹਾਂਗੇ ਕੰਮ ਕਰਨ ਵਾਸਤੇ ਅਤੇ ਹੁਣ ਤਾਂ ਸਗੋਂ ਦੁਨੀਆਂ ਸੌਖੀ ਹੋ ਗਈ ਹੈ ਪਹਿਲਾਂ ਸਟੋਪਾਂ 'ਤੇ ਵੀ ਕੰਮ ਕਰਦੇ ਰਹੇ ਸਟੋਪ ਬਾਲ ਕੇ ਫਿਰ ਬਿਜਲੀ ਵਾਲੇ ਹੀਟਰ ਆ ਗਏ ਹੁਣ ਜਦੋਂ ਦੇ ਗੈਸ ਚੁੱਲ੍ਹੇ ਆਏ ਆ ਉਦੋਂ ਦੇ ਤਾਂ ਬਹੁਤ ਹੀ ਲੋਕ ਸੌਖੇ ਹੋ ਗਏ ਹਨ ਹੁਣ ਤਾਂ ਕੋਈ ਅੱਗ ਬਾਲਣੀ ਪਸੰਦ ਹੀ ਨਹੀਂ ਕਰਦਾ ਗਾ ਸਭ ਦੂਰ ਰਹਿੰਦੇ ਆ ਚੁੱਲ੍ਹਿਆਂ ਤੋਂ ਅਤੇ ਪਰ ਜ਼ਮਾਨਾ ਜਿਹੜਾ ਬਹੁਤ ਬਦਲ ਗਿਆ ਇਸ ਕਰਕੇ ਮਤਲਬ ਕਿ ਲੋਕ ਸੌਖੇ ਹੋਣ ਕਰਕੇ ਹੁਣ ਕੋਈ ਤਕਲੀਫ ਨਹੀਂ ਆਉਂਦੀ ਸਰੀਰ ਨੂੰ ਚੁੱਪ ਕਰਕੇ ਬੈ ਬਟਨ ਗੈਸ ਦਾ ਲਾਓ ਅਤੇ ਕੰਮ ਕਰ ਲਓ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਰੋਟੀਆਂ ਬਣਾਉਂਦੇ ਕਿਹੜੇ ਵੇਲੇ ਕੋਈ ਖਾਣਾ ਬਣਾਉਂਦਾ ਕਿਹੜੇ ਵੇਲੇ ਨਹੀਂ ਬਣਾਉਂਦਾ ਅਤੇ ਚੁੱਲ੍ਹੇ ਦੀ ਅੱਗ ਬਲਦੀ ਸੀ ਤਾਂ ਸਾਰੇ ਘਰਾਂ 'ਚ ਪਤਾ ਲੱਗ ਜਾਂਦਾ ਸੀ ਵੀ ਫਲਾਨੇ ਘਰ ਚੁੱਲ੍ਹੇ ਦਾ ਧੂੰਆਂ ਉੱਠਦਾ ਉਹਨਾਂ ਦੇ ਘਰ ਕੁਛ ਬਣ ਰਿਹਾ ਅਤੇ ਹੁਣ ਸਟੋਪਾਂ ਦਾ ਇਹਨਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਚੁੱਲ੍ਹਿਆਂ ਦਾ ਤਾਂ ਗੈਸੀ ਚੁੱਲ੍ਹਿਆਂ ਦਾ ਤਾਂ ਅਤੇ ਬਾਕੀ ਇਹ ਗੱਲ ਆ ਵੀ ਜਦੋਂ ਇਹ ਜਿਹੜਾ ਆ ਸਲੰਡਰ ਆ ਵਰਤਣ ਵਾਸਤੇ ਸਰੀਰ ਨੂੰ ਥੋੜ੍ਹਾ ਜਿਹਾ ਤਾਅ ਦੇਣਾ ਪੈਂਦਾ ਵੀ ਸ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਜਿਹੜਾ ਇਹ ਗੈਸੀ ਚੁੱਲ੍ਹੇ ਆ ਇਹਨਾਂ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਰੱਖਣਾ ਚਾਹੀਦਾ ਗੈਸ ਲੀਕ ਨਾ ਹੋਵੇ ਅਤੇ ਸਲੰਡਰ ਲੀਕ ਨਾ ਹੋਵੇ ਲੈਣ ਸਲੰਡਰ ਲੈਣ ਲੱਗਿਆਂ ਵੀ ਗੈ ਗੈਸ ਦੀ ਜਿਹੜੀ ਚੈੱਕ ਕਰਕੇ ਲੈਣਾ ਚਾਹੀਦਾ ਸਲੰਡਰ ਕਿਉਂਕਿ ਕਈ ਵਾਰੀ ਇਹ ਲੀਕ ਕਰਨ ਲੱਗ ਜਾਂਦਾ ਅਤੇ ਉਹ ਨਹੀਂ ਤਾਂ ਉਹ ਬਹੁਤ ਨੁਕਸਾਨ ਕਰਦਾ ਗੈਸ ਦੀ ਪੈਪ ਹਰ ਰੋਜ਼ ਚੈੱਕ ਕਰਦੇ ਰਹੋ ਇਹ ਜੇ ਕੋਈ ਲੀਕੇਜ ਹੋਵੇ ਤਾਂ ਕੰਪਨੀ ਵਾਲਿਆਂ ਨੂੰ ਫੋਨ ਕਰੋ ਅਤੇ ਉਹ ਆ ਕੇ ਵੇਖ ਕੇ ਜਾਣਗੇ ਤੁਹਾਡਾ ਸਿਲੰਡਰ ਬਦਲ ਦੇਣਗੇ ਜਾਂ ਤੁਹਾਨੂੰ ਦੱਸਣਗੇ ਆਹ ਆਹ ਇਸ ਤਰ੍ਹਾਂ ਹੈ ਮਤਲਬ ਅਤੇ ਸ ਇਸ ਤਰ੍ਹਾਂ ਆਪਾਂ ਹਰ ਚੀਜ਼ ਵਰਤੀਏ ਸਾਵਧਾਨੀ ਨਾਲ ਹੀ ਵਰਤਣੀ ਪੈਂਦੀ ਹੈ ਅਤੇ ਧਿਆਨ ਰੱਖਣਾ ਪੈਂਦਾ